ਮੈਨੂੰ ਨੋਨ ਵੈੱਜ ਪਕਵਾਨ ਬਹੁਤ ਮੁਸ਼ਕਲ ਲੱਗਦੇ ਹਨ ਕਿਉਂਕਿ ਉਹ ਮੈਂ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਉਹ ਮੈਨੂੰ ਵਧੀਆ ਨਹੀਂ ਲੱਗਦੇ ਬਣਾਉਣੇ ਪਰ ਮੈਂ ਉਹਨਾਂ ਨੂੰ ਸਿੱਖਣਾ ਚਾਹੁੰਦੀ ਹਾਂ ਤਾਂ ਜੋ ਮੈਨੂੰ ਅੱਗੇ ਜਾ ਕੇ ਕੋਈ ਮੁਸ਼ਕਲ ਨਾ ਆਵੇ ਇਸ ਲਈ ਮੈਂ ਜਿਹੜੇ ਨਾਨ ਵੈੱਜ ਪਕਵਾਨ ਨੇ ਸਾਰੇ ਉਹ ਸਿੱਖਣਾ ਚਾਹੁੰਦੀ ਹਾਂ ਇਸ ਲਈ ਮੈਨੂੰ ਉਹਨਾਂ ਨੂੰ ਬਣਾਉਣ 'ਚ ਮੁਸ਼ਕਲ ਆਉਂਦੀ ਆ ਇੱਕ ਤਾਂ ਮੈਨੂੰ ਉਹ ਵਧੀਆ ਨਹੀਂ ਲੱਗਦੇ ਦੂਜਾ ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨੇ ਕੁ ਮਸਾਲੇ ਪੈਂਦੇ ਹੋਣਗੇ ਕੀ ਕੁਛ ਪੈਂਦਾ ਹੋਊਗਾ ਉਹਨਾਂ ਨੂੰ ਕਿਵੇਂ ਬਣਾਇਆ ਜਾਊਗਾ ਬਸ ਮੈਂ ਉਹਨਾਂ ਨੂੰ ਸਿੱਖਣਾ ਚਾਹੁੰਦੀ ਹਾਂ ਤਾਂ ਜੋ ਅੱਗੇ ਜਾ ਕੇ ਮੈਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਮੈਂ ਅਜੇ ਤੱਕ ਅਜੇ ਤੱਕ ਉਹਨਾਂ ਦੀ ਕੋ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇਨ ਫਿਊਚਰ ਮੈਂ ਕੋਸ਼ਿਸ਼ ਕਰਾਂਗੀ ਅਤੇ ਉਹਨਾਂ ਜਿਹੜੇ ਪਕਵਾਨ ਮੈਨੂੰ ਲੱਗਦੇ ਨੇ ਗੇ ਵੀ ਨੋਨ ਵੈੱਜ ਮੈਨੂੰ ਮੁਸ਼ਕਲ ਲੱਗਦਾ ਆ ਬਹੁਤ ਜ਼ਿਆਦਾ ਮੁਸ਼ਕਲ ਲੱਗਦਾ ਉਹਨਾਂ ਨੂੰ ਮੈਂ ਸਿੱਖਾਂਗੀ